ਹਾਂਜੀ ਦੌੜਨਾ ਮੇਰੀ ਹੋਬੀ ਹੈ ਮੇਰਾ ਸ਼ੌਂਕ ਹੈ ਜਦੋਂ ਮੈਂ ਦੌੜਨ ਜਾਂਦਾ ਸ਼ਾਮ ਨੂੰ ਗਰਾਉਂਡ ਦੇ ਵਿੱਚ ਤਾਂ ਉਦੋਂ ਮੈਨੂੰ ਹੁੰਦਾ ਹੈ ਕਿ ਮੈਂ ਬੜਾ ਆਪਣੇ ਧਿਆਨ ਦੇ ਨਾਲ ਜਿਹੜਾ ਮੇਰਾ ਧਿਆਨ ਮੇਰੀ ਦੋੜ ਉੱਤੇ ਹੋਵੇ ਮੇਰਾ ਸ਼ੌਂਕ ਹੈ ਮੇਰਾ ਪੈਸ਼ਨ ਹੈ ਦੌੜਨਾ ਜਦੋਂ ਮੈਂ ਦੌੜਦਾ ਤਾਂ ਕੰਨਾਂ ਦੇ ਵਿੱਚ ਮੈਂ ਮਿਊਜਿਕ ਕਈ ਵਾਰ ਲਗਾ ਲੈਂਦਾ ਤਾਂ ਮਿਊਜਿਕ ਜੋ ਮੇਰਾ ਫੇਵਰਟ ਹੈ ਉਹ ਸਤਿੰਦਰ ਸਰਤਾਜ ਦਾ ਜਾਂ ਪੁਰਾਣੇ ਹਿੰਦੀ ਗਾਣੇ ਜਿਹੜੇ ਮੇਰੇ ਫੇਵਰੇਟ ਨੇ ਉਹ ਮੈਂ ਗਾਣੇ ਚਲਾ ਲੈਂਦਾ ਮੱਧਮ ਮੱਧਮ ਗਾਣੇ ਹੌਲੀ ਹੌਲੀ ਗਾਣੇ ਚੱਲਦੇ ਰਹਿੰਦੇ ਨੇ ਅਤੇ ਮੈਂ ਆਪਣੀ ਦੌੜ ਦੇ ਵਿੱਚ ਆਪਣਾ ਦੌੜਦਾ ਰਹਿੰਦਾ ਮੈਨੂੰ ਦੌੜਨ ਦੇ ਵਿੱਚ ਇੰਨਾ ਕੁ ਮਜ਼ਾ ਆਉਂਦਾ ਕਿ ਮੈਨੂੰ ਲੱਗਦਾ ਮੇਰੀ ਸਾਰੀ ਥਕਾਨ ਕੀ ਹੋ ਗਈ ਦੂਰ ਹੋ ਗਈ ਲੇਕਿਨ ਕਈ ਵਾਰ ਕੀ ਹੁੰਦਾ ਮਿਊਜਿਕ ਲਗਾਉਣ ਦਾ ਦਿਲ ਨਹੀਂ ਹੁੰਦਾ ਤਾਂ ਉਦੋਂ ਫਿਰ ਮੈਂ ਆਪਣੇ ਕਿਸੇ ਦੋਸਤ ਦੇ ਨਾਲ ਦੌੜ ਕਰਨੀ ਪਸੰਦ ਕਰਦਾ ਜਦੋਂ ਦੌ ਉਸ ਦੇ ਨਾਲ ਦੌੜ ਕਰ ਰਿਹਾ ਹੁੰਦਾ ਭੱਜ ਰਿਹਾ ਹੁੰਦਾ ਤਾਂ ਅਸੀਂ ਇੱਕ ਦੂਜੇ ਦੇ ਨਾਲ ਆਪਣੀ ਗੱਲਾਂ ਆਪਣੇ ਸ਼ੌਂਕ ਆਪਣੀ ਜੋ ਦਿਨ ਚਰਿਆ ਆਪਣੀ ਜੋ ਕਿਸੇ ਵੀ ਤਰ੍ਹਾਂ ਦੀ ਕਮੀਆਂ ਉਹ ਅਸੀਂ ਡਿਸਕਸ ਕਰਦੇ ਰਹਿੰਦੇ ਹਾਂ ਉਹ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ ਜਿਹੜੀਆਂ ਕੀ ਹੈ ਮੈਂ ਸਾਰੇ ਦਿਨ ਦੀ ਮੇਰੀ ਥਕਾਨ ਕੀ ਹੋ ਜਾਂਦੀ ਦੂਰ ਹੋ ਜਾਂਦੀ ਹੈ ਅਤੇ ਜਦੋਂ ਮੈਂ ਦੌੜਦਾ ਓ ਮੈਨੂੰ ਐਂ ਲੱਗਦਾ ਕਿ ਮੇਰੇ ਸਾਰੇ ਦਿਨ ਦੀ ਥਕਾਵਟ ਕੀ ਹੋ ਗਈ ਉਤਰ ਗਈ ਹੈਗੀ ਗਾਣੇ ਜਦੋਂ ਗਾਣਾ ਸੁਣਦਾ ਤੋ ਹਲਕਾ ਹਲਕਾ ਮਿਊਜਿਕ ਹਲਕਾ ਹਲਕਾ ਮਿਊਜਿਕ ਜਦੋਂ ਚੱਲਦਾ ਰਹਿੰਦਾ ਹੈ ਤਾਂ ਐਂ ਲੱਗਦਾ ਸਾਰੀ ਥਕਾਵਟ ਕੀ ਹੋ ਗਈ ਦੂਰ ਹੋ ਗਈ ਉਹ ਗਾਣੇ ਇੰਨੀ ਕੁ ਪਿਆਰ ਨਾਲ ਚੱਲਦੇ ਵੀ ਹੁੰਦੇ ਨੇ ਤਾਂ ਦਿਮਾਗ ਸਿਰਫ਼ ਉਹਦੇ 'ਚ ਘੁੰਮਦਾ ਰਹਿੰਦਾ ਅਤੇ ਸਰੀਰ ਐਂ ਲੱਗਦਾ ਬਿਲਕੁਲ ਕੀ ਹੈ ਤੰਦਰੁਸਤ ਹੋ ਰਿਹਾ ਸਰੀਰ ਬਿਲਕੁਲ ਕੀ ਮੇਰਾ ਕੀ ਹੋ ਰਿਹਾ ਖਾਲੀ ਹੋ ਰਿਹਾ ਅਤੇ ਮੈਂ ਉਸ ਦੌੜ ਦੇ ਵਿੱਚ ਹੌਲੀ ਹੌਲੀ ਦੌੜਦਾ ਜਾਂਦਾ ਸ਼ਾਮ ਨੂੰ ਜਦੋਂ ਮੈਂ ਦੌੜਨ ਜਾਂਦਾ ਸ਼ਾਮ ਪੰਜ ਵਜੇ ਮੈਂ ਗਰਾਊਂਡ ਚਲਾ ਜਾਂਦਾ ਪੰਜ ਵਜੇ ਤੋਂ ਲੈ ਕੇ ਛੇ ਵਜੇ ਤੱਕ ਸਾਢੇ ਛੇ ਤੱਕ ਜਦੋਂ ਤੱਕ ਮੇਰਾ ਸਰੀਰ ਤਰੋਤਾਜ਼ਾ ਨਹੀਂ ਹੁੰਦਾ ਮੈਂ ਗਰਾਊਂਡ ਦੇ ਵਿੱਚ ਦੌੜਦਾ ਰਹਿੰਦਾ ਦੌੜਦੇ ਦੌੜਦੇ ਮੈਨੂੰ ਪਤਾ ਹੀ ਨਹੀਂ ਚੱਲਦਾ ਮੇਰੀ ਕੀ ਤਕਲੀਫਾਂ ਨੇ ਜਾਂ ਮੇਰੀ ਕੀ ਘਰ ਔਕੜਾਂ ਨੇ ਮੈਂ ਸਭ ਕੁਛ ਭੁੱਲ ਜਾਂਦਾ ਸਿਰਫ਼ ਉਸ ਟਾਈਮ ਮੇਰਾ ਧਿਆਨ ਮੇਰੇ ਸਰੀਰ ਉੱਤੇ ਹੁੰਦਾ ਮੇਰੇ ਸਰੀਰ ਉੱਤੇ ਕੇਂਦਰਿਤ